ਮੈਂ ਆਪਣੀ ਚੱਲ ਰਹੀ ਰੂਟੀਨ ਵਿੱਚ ਤਾਕਤ ਅਤੇ ਲਚਕਤਾ ਲਈ ਯੋਗ ਦੀ ਬਹੁਤ ਜ਼ਿਆਦਾ ਮਦਦ ਲੈਂਦਾ ਹਾਂ ਅਤੇ ਕਈ ਤਰ੍ਹਾਂ ਦੇ ਮੈਂ ਆਸਣ ਵੀ ਕਰਦਾ ਹਾਂ ਜਿਵੇਂ ਭੁਝੰਗ ਆਸਣ ਭੁਝੰਗ ਆਸਣ ਸਰਪ ਆਸਣ ਅਤੇ ਹੋਰ ਵੀ ਕਈ ਤਰ੍ਹਾਂ ਦੇ ਆਸਣ ਹਨ ਤਾਂ ਕਰਦਾ ਹਾਂ ਅਤੇ ਮੇਰੇ ਸਰੀਰ ਵਿੱਚ ਇਹ ਚੀਜ਼ਾਂ ਲਚਕਤਾ ਅਤੇ ਤਾਕਤ ਲੈ ਕੇ ਆਉਂਦੀਆਂ ਹਨ ਅਤੇ ਹੋਰ ਵੀ ਜ਼ਿਆਦਾ ਤਾਕਤ ਨੂੰ ਵਧਾਉਣ ਲਈ ਮੈਂ ਡੰਡ ਅਤੇ ਡੰਡ ਵੀ ਲਾਉਂਦਾ ਹਾਂ ਅਤੇ ਰੱਸਾ ਵੀ ਚੜ੍ਹਦਾ ਹਾਂ ਅਤੇ ਇਸ ਕਾਰਨ ਮੇਰੀ ਬਾਡੀ ਵਿੱਚ ਲਚਕਤਾ ਵੀ ਘ ਰਹਿੰਦੀ ਹੈ ਅਤੇ ਜੇ ਮੇਰੀ ਖਿੱਚਣ ਦੀ ਰੂਟੀਨ ਦੀ ਗੱਲ ਕਰੀਏ ਤਾਂ ਅਸੀਂ ਸਾਰੇ ਜਣੇ ਸ਼ਾਮ ਨੂੰ ਜਾਂਦੇ ਗਰਾਊਂਡ ਜਾਂਦੇ ਹਾਂ ਅਤੇ ਅਸੀਂ ਇੱਕ ਦੂਜੇ ਨੂੰ ਦੇਖ ਕੇ ਆਪਣੀ ਰੂਟੀਨ ਖਿੱਚਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਅਸੀਂ ਹੋਰ ਵੀ ਖਿੱਚਣ ਲਈ ਆਪਣੇ ਸਰੀਰ ਨੂੰ ਫਿਟ ਰੱਖਣ ਲਈ ਰਨਿੰਗ ਵੀ ਕਰਦੇ ਹਾਂ ਇਸ ਲਈ ਇਸ ਇਸ ਰੂਟੀਨ ਨਾਲ ਸਾਡੇ ਵਿੱਚ ਤਾਕਤ ਅਤੇ ਲਚਕਤਾ ਬਣੀ ਰਹਿੰਦੀ ਹੈ